ਕਲਾ ਜਗਤ ਬਹੁਤ ਵੱਡੀ ਚੀਜ਼ ਆ ਚਲੋ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਵਾ ਹਰ ਇੱਕ ਚੀਜ਼ ਯੂਟੀਊਬ ਏ ਆਈ ਦੇ ਨਾਲ ਸਭ ਕੁਝ ਉੱਥੋਂ ਹੋ ਜਾਂਦਾ ਵਾ ਅਤੇ ਕਲਾ ਕਲਾ ਕੀ ਕਲਾ ਮਤਲਬ ਮੈਂ ਤਾਂ ਯੂਟੀਊਬ ਤੋਂ ਹਰ ਇੱਕ ਚੀਜ਼ ਦੇਖ ਲੈਂਦੀ ਹਾਂ ਕਿ ਹਾਂ ਇੰਟਰਨੈਟ ਫੇਸਬੁਕ 'ਤੇ ਕੋਈ ਚੀਜ਼ ਕਰਨੀ ਆ ਯੂਟਿਊਬ ਤੋਂ ਦੇਖੋ ਅਤੇ ਏ ਆਈ ਦਾ ਜ਼ਮਾਨਾ ਵਾ ਸਭ ਕੁਛ ਉੱਥੋਂ ਹੋ ਜਾਂਦਾ ਵਾ ਅਤੇ ਬੜੀਆਂ ਨਵੀਆਂ ਤਕਨੀਕਾਂ ਆਈਆਂ ਵਾ ਅੱਜ ਕੱਲ੍ਹ ਉਹਨਾਂ ਕਰਕੇ ਰੁਝੇਵਾਂ ਰਹਿੰਦਾ ਵਾ ਅਤੇ ਵਧੀਆ ਵਾ ਕਲਾ ਦੇ ਨਾਲ ਜੁੜਨਾ ਵੀ ਚਾਹੀਦਾ ਵਾ ਆਪਾਂ ਨੂੰ ਵਧੀਆ ਤਰੀਕੇ ਦੇ ਨਾਲ ਕਲਾ ਹੁੰਦੀ ਆ ਅਤੇ ਵੈਸੇ ਤਾਂ ਕਲਾ ਦੇ ਵੀ ਸ਼ਬਦ ਮਾਈਨੇ ਕਲਾ ਬਹੁਤ ਵਧੀਆ ਚੀਜ਼ ਆ ਚੱਲੋ ਅਤੇ